ਸਤਿ ਸ਼੍ਰੀ ਅਕਾਲ ਜੀ ਉੱਦਾਂ ਤਾਂ ਮੈਂ ਸਾਰੇ ਪਕਵਾਨ ਬਣਾ ਲੈਂਦੀ ਹਾਂ ਸਿਰਫ ਮੈਨੂੰ ਇੱਕ ਸਾਗ ਦੀ ਮੁਸ਼ਕਲ ਲੱਗਦੀ ਹੈ ਮੈਨੂੰ ਸਾਗ ਨਹੀਂ ਬਣਾਉਣਾ ਆਉਂਦਾ ਕਿਉਂਕਿ ਇਸ ਸਾ ਸ ਸਾਰੇ ਸਾਗ ਸਭ ਨੂੰ ਬਹੁਤ ਪਸੰਦ ਹੈ ਇਸ ਲਈ ਮੈਂ ਬੜੀ ਕੋਸ਼ਿਸ਼ ਕਰਦੀ ਹਾਂ ਬਣਾਉਣ ਦੀ ਮੈਨੂੰ ਵੀ ਬਹੁਤ ਪਸੰਦ ਆ ਮੈਂ ਬਣਾਵਾਂ ਮੈਂ ਬਣਾ ਕੇ ਸਾਰਿਆਂ ਨੂੰ ਸਾਗ ਖਵਾਵਾਂ ਨਾਲ ਹੀ ਮੱਕੀ ਦੀ ਰੋਟੀ ਸਰੋਂ ਦਾ ਸਾਗ ਇਹ ਸਭ ਨੂੰ ਬਹੁਤ ਘਰ 'ਚੋਂ ਪਸੰਦ ਹੈ ਇਹ ਮੈਂ ਬਹੁਤ ਕੋਸ਼ਿਸ਼ ਕਰਦੀ ਹਾਂ ਮੈਂ ਬਣਾ ਕੇ ਦੇਵਾਂ ਪਰ ਮੈਨੂੰ ਬਣਾਉਣਾ ਨਹੀਂ ਆਉਂਦਾ ਇਹ 'ਚ ਮੁਸ਼ਕਲ ਕੀ ਹੈ ਕਿ ਇਹਨੂੰ ਧੋਣਾ ਵੀ ਪੈਂਦਾ ਚੀਰਨਾ ਵੀ ਪੈਂਦਾ ਬਸ ਇਹ ਕੰਮ ਨਹੀਂ ਹੁੰਦੇ ਸਾਗ ਤਾਂ ਇੰਨੀ ਅੱਛੀ ਚੀਜ਼ ਹੈ ਸਿਹਤਮੰਦ ਇੱਕ ਹਰਾ ਸਾਗ ਖਾਣਾ ਚਾਹੀਦਾ ਹੈ ਸਰੀਰ ਵਾਸਤੇ ਤੰਦਰੁਸਤੀ ਦਿੰਦਾ ਹੈ ਔਰ ਤਾਕਤਵਰ ਹੁੰਦਾ ਹੈ ਸਾਰੇ ਬੱਚੇ ਮੇਰੇ ਬਹੁਤ ਪਸੰਦ ਕਰਦੇ ਹਾਂ ਪਰ ਮੈਨੂੰ ਸਾਗ ਬਣਾਉਣਾ ਹੀ ਨਹੀਂ ਆਉਂਦਾ ਇਸ ਵਾਸਤੇ ਮੈਂ ਜਾਚ ਵੀ ਸਿੱਖਣਾ ਚਾਹੁੰਦੀ ਹਾਂ ਅਤੇ ਇੱਕ ਵਾਰ ਬਣਾ ਕੇ ਵੀ ਦੇਖੂੰਗੀ ਧੰਨਵਾਦ ਜੀ